ਜੀ ਹਾਂ ਮੈਨੂੰ ਔਡੀਓ ਬੁੱਕ ਸੁਣਨ ਦਾ ਬਹੁਤ ਸ਼ੌਕ ਹੈ ਔਡੀਓ ਬੁੱਕਸ ਸੁਣਨ ਨਾਲ ਮੈਨੂੰ ਲੰਬੇ ਸਮਾਂ ਤੱਕ ਕੁਝ ਨਵੇਂ ਅਤੇ ਸ਼ਾਇਦ ਅਜਿਹੀਆਂ ਗੱਲਾਂ ਬਾਰੇ ਸਿੱਖਣ ਨੂੰ ਦਾ ਮੌਕਾ ਮਿਲਦਾ ਹੈ ਕੁਛ ਮਨਪਸੰਦ ਵਿਸ਼ਿਆਂ ਵਿੱਚ ਆਡੀਓ ਬੁੱਕਸ ਸੁਣਨ ਦਾ ਅਨੁਭਵ ਵਾਸਤਵਿਕ ਅਤੇ ਰੋਮਾਂਚਿਕ ਹੁੰਦਾ ਹੈ ਇਹ ਸਮੇਂ ਵਿੱਚ ਸੁਣੀਆ ਗਈਆਂ ਕਹਾਣੀਆਂ ਵਧੀਆ ਤਰੀਕੇ ਨਾਲ ਸਮਝੋ ਸਮਝਾਉਂਦੀਆਂ ਹਨ ਅਤੇ ਲੋਕਾਂ ਦੇ ਜੀਵਨ ਵਿੱਚ ਹੱਲ ਚਾਹੀਦੇ ਹੋਏ ਗਾਹਕਾਂ ਦੇ ਆਕਰਸ਼ਣ ਨੂੰ ਵਧਾਉਂਦੀਆਂ ਹਨ ਸੁਣਨ ਨਾਲ ਆਪਣੀ ਸੋਚ ਅਤੇ ਗਿਆਨ ਨੂੰ ਵਧਾਉਣ ਦਾ ਇੱਕ ਸੁਨਹਿਰੀ ਮੌਕਾ ਮਿਲਣਾ ਹੈ ਜਦੋਂ ਕਿ ਤੁਸੀਂ ਸਰੀਰਕ ਕਿਰਿਆ ਦੇ ਦੌਰਾਨ ਵੇਖ ਨਹੀਂ ਸਕਦੇ ਜੀ ਹਾਂ ਮੈਨੂੰ ਇਲੈਕਟ੍ਰੋਨਿਕ ਕਿਤਾਬਾਂ ਪੜ੍ਹਨ ਦਾ ਵੀ ਬਹੁਤ ਸ਼ੌਂਕ ਹੈ ਇਹ ਮੈਨੂੰ ਨਵੀਨਤਮ ਤਨਿਕ ਤਕਨੀਕੀ ਅਤੇ ਪ੍ਰਗਤੀਸ਼ੀਲ ਜਾਣਕਾਰੀ ਨੂੰ ਹਾਸਿਲ ਕਰਨ ਵਿੱਚ ਮਦਦ ਕਰਦੀ ਹੈ ਇਸ ਵਿੱਚ ਮੈਂ ਵੱਡੇ ਪ੍ਰਕਾਰ ਦੀਆਂ ਕਿਤਾਬਾਂ ਵਾਲੀਆਂ ਕਿਤਾਬਾਂ ਤਕਨੀਕੀ ਗਿਆਨ ਸਾਹਿਤ ਅਤੇ ਸ਼ੋਸ਼ਲ ਸਾਇੰਸ ਦੀਆਂ ਕਿਤਾਬਾਂ ਪੜ੍ਹੀਆਂ ਹਨ ਅਤੇ ਉਹ ਮੈਨੂੰ ਬਹੁਤ ਹੀ ਪ੍ਰੇਰਿਤ ਕਰਦੀਆਂ ਹਨ ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਅਤੇ ਜਪੁਜੀ ਸਾਹਿਬ ਅਤੇ ਜ਼ਿਆਦਾਤਰ ਸਾਰੇ ਹੀ ਪਾਠ ਨੂੰ ਅਸੀਂ ਔਡੀਓ ਵਿੱਚ ਸੁਣ ਵੀ ਸਕਦੇ ਹਾਂ ਅਤੇ ਪੜ੍ਹ ਵੀ ਸਕਦੇ ਹਾਂ ਅਤੇ ਮੈਂ ਵੀ ਕਈ ਵਾਰ ਘਰ ਦਾ ਕੰਮ ਕਰਦੀ ਕਰਦੀ ਨਾਲ ਨਾਲ ਔਡੀਓ ਲਗਾ ਲੈਂਦੀ ਹਾਂ ਜਿਸ ਨਾਲ ਮੇਰੇ ਮੇਰਾ ਸਮਾਂ ਵੀ ਬਚ ਜਾਂਦਾ ਹੈ ਅਤੇ ਕਈ ਹੋਰ ਕੰਮ ਨਾਲ ਹੋ ਜਾਂਦੇ ਹਨ ਅਤੇ ਇਸ ਅਤੇ ਇਹ ਹੀ ਬੁੱਕਸ ਨੇ ਸਾਡੀ ਇਹਨਾਂ ਬੁੱਕਸ ਨੇ ਸਾਡੀ ਜ਼ਿੰਦਗੀ ਨੂੰ ਹੋਰ ਸੁਖਾਲਾ ਬਣਾ ਦਿੱਤਾ ਹੈ ਅਸੀਂ ਹਰ ਤਰ੍ਹਾਂ ਦਾ ਕੋਈ ਗੀਤ ਕੋਈ ਹੋਰ ਤਰ੍ਹਾਂ ਬੜੀ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਔਡੀਓ ਰਾਹੀਂ ਸੁਣ ਸਕਦੇ ਹਾਂ ਜਿਸ ਨਾਲ ਸਾਡਾ ਬਹੁਤ ਹੀ ਸਮਾਂ ਬਚ ਜਾਂਦਾ ਹੈ ਅਤੇ ਇਹੀ ਸਮਾਂ ਅਸੀਂ ਹੋਰ ਕਿਸੇ ਕੰਮ ਵਿੱਚ ਯੂਸ ਵਰਤੋਂ ਇਸ ਸਮੇਂ ਦੀ ਵਰਤੋਂ ਕਰ ਸਕਦੇ ਹਾਂ ਇਹ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਔਡੀਓ ਆਪਾਂ ਜ ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ਕਈ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਆਪਾਂ ਨੂੰ ਇ ਇਸ ਦੇ ਮਸਲੇ ਹੱਲ ਇਹਨਾਂ ਦੇ ਨਾਲ ਮਸਲੇ ਹੱਲ ਹੁੰਦੇ ਹਨ ਔਡੀਓ ਸੁਣਨ ਨਾਲ ਸਾਡੇ ਵੈਸੇ ਦਿਮਾਗ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਹਨ ਜੋ ਕਿ ਆਹਾ ਇਹਨਾਂ ਇਹ ਕੈਸਟਾਂ ਨੂੰ ਕਿਤਾਬਾਂ ਨੂੰ ਪੜ੍ਹ ਸੁਣ ਕੇ ਇਸ ਨੂੰ ਇਸਤੇਮਾਲ ਦੇ ਵਿੱਚ ਲਿਆ ਸਕਦੇ ਹਾਂ ਧੰਨਵਾਦ